ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੇਰੀ ਗੱਲ ਓਲਾ ਸਰਵਿਸ ਸੈਂਟਰ 'ਤੇ ਹੋ ਰਹੀ ਹੈ ਹਾਂਜੀ ਹਾਂਜੀ ਸਰ ਸਰ ਮੇਰਾ ਨਾਮ ਲਕਸ਼ੇ ਕੁਮਾਰ ਆ ਸਰ ਮੈਂ ਨਾ ਤੁਹਾਡੀ ਕੈਬ ਬੁੱਕ ਕਰਵਾਈ ਸੀਗੀ ਚਾਰ ਦਿਨ ਪਹਿਲਾਂ ਸਰ ਮੈਨੂੰ ਨਾ ਕਿਤੇ ਬੜਾ ਜ਼ਰੂਰੀ ਜਾਣਾ ਸੀਗਾ ਅਤੇ ਕੈਬ ਤਾਂ ਸਰ ਚਲੋ ਤੁਹਾਡੀ ਟੈਮ ਸਿਰ ਆ ਗੀ ਸੀਗੀ ਪਰ ਸਰ ਜਦੋਂ ਮੈਂ ਉੱਥੇ ਬੈਠਾ ਨਾ ਸਰ ਕੈਬ ਬਹੁਤ ਜ਼ਿਆਦਾ ਗੰਦੀ ਸੀਗੀ ਸਰ ਮੇਰਾ ਜਾਣਾ ਵੀ ਜ਼ਰੂਰੀ ਸੀਗਾ ਤਾਂ ਕਰਕੇ ਸਰ ਮੈਂ ਚੇਂਜ ਵੀ ਨਾ ਕਰ ਪਾਇਆ ਚਲੋ ਸਰ ਕੈਬ ਤਾਂ ਗੰਦੀ ਸੀਗੀ ਮੈਂ ਚਲਾ ਗਿਆ ਫਿਰ ਵੀ ਕੋਈ ਗੱਲ ਨਹੀਂ ਪਹੁੰਚਣਾ ਜ਼ਰੂਰੀ ਸੀਗਾ ਸਰ ਜਿਵੇਂ ਮੈਂ ਪਹੁੰਚਿਆ ਅਤੇ ਸਰ ਤੁਹਨੂੰ ਪਤਾ ਇਸ ਟੈਮ ਥੋੜ੍ਹਾ ਨਾ ਕੋਵਿਡ ਦਾ ਮਾਹੌਲ ਹੈ ਅਤੇ ਸਰ ਡਰੈਵਰ ਨੇ ਸਰ ਮਾਸਕ ਤੱਕ ਨਹੀਂ ਈਵਨ ਯੂਜ਼ ਕੀਤਾ ਸੀਗਾ ਮੈਂ ਓਹਨਾਂ ਨੂੰ ਸਰ ਦੋ ਤਿੰਨ ਵਾਰੀ ਕਿਹਾ ਕਿ ਮਾਸਕ ਯੂਜ਼ ਕਰ ਲਉ ਓਹ ਕਹਿੰਦੇ ਤੁਸੀਂ ਚੁੱਪ ਕਰਕੇ ਬਹੋ ਤੁਹਾਨੂੰ ਨਹੀਂ ਹੁੰਦਾ ਯੇ ਹੈ ਵੋ ਹੈ ਮਤਲਬ ਸਰ ਰੂਡ ਬੋਲੇ ਮੈਨੂੰ ਮਤਲਬ ਬਿਲਕੁਲ ਵੀ ਬੋਲਣ ਦੀ ਸਰ ਤਮੀਜ ਨਹੀਂ ਸੀਗੀ ਪਰ ਸਰ ਸਟਿੱਲ ਮੈਂ ਗਿਆ ਮੈਂ ਆਪਣਾ ਸਰ ਮਾਸਕ ਯੂਜ਼ ਕੀਤਾ ਸੀਗਾ ਹਾਂਜੀ ਹਾਂਜੀ ਸਰ ਗੱਡੀ ਗੱਡੀ ਸਰ ਮਰੁਤੀ ਸਜੁੁੱਕੀ ਸੀਗੀ ਹਾਂਜੀ ਸਰ ਗੱਡੀ ਨੰਬਰ ਸਰ ਪੀ ਬੀ ਜੀਰੋ ਟੂੂ ਡੀ ਬੀ ਸੋਲ਼੍ਹਾਂ ਗਿਆਰ੍ਹਾਂ ਡਰਾਈਵਰ ਦਾ ਨਾਮ ਸਰ ਉੱਥੇ ਸ਼ੋਅ ਹੋ ਰਿਹਾ ਹਰਵਿੰਦਰ ਸਿੰਘ ਹਾਂਜੀ ਸਰ ਸਰ ਡਰਾਈਵਿੰਗ ਸਰ ਬਹੁਤ ਰੈਸ਼ ਕੀਤੀ ਓਹਨਾਂ ਨੇ ਹਾਂਜੀ ਸਰ ਜੇ ਸਰ ਮੈਂ ਓਹਨਾਂ ਨੂੰ ਜ਼ਿਆਦਾ ਕਹਿਣ ਡਿਆ ਤਾਂ ਸਰ ਮੈਨੂੰ ਰੂਡ ਬੋਲਦੇ ਸੀਗੇ ਸਰ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਓਹਨਾਂ ਦੇ ਖਿਲਾਫ ਥੋੜ੍ਹੇ ਐਕਸ਼ਨ ਲਓ ਸਖਤ ਤੋਂ ਸਖਤ ਐਕਸ਼ਨ ਲਉ ਸਰ ਆਉਣ ਵਾਲੇ ਟੈਮ 'ਚ ਕਿਸੇ ਹੋਰ ਨੂੰ ਨਾ ਇਹ ਦਿੱਕਤ ਆਵੇ ਸਰ ਇਸ ਚੀਜ਼ ਦਾ ਧਿਆਨ ਰੱਖਿਓ ਹਾਂਜੀ ਸਰ ਹਾਂਜੀ ਧੰਨਵਾਦ ਸਰ ਧੰਨਵਾਦ